ਹਾਂਜੀ ਮੈ ਅੱਜ ਤੁਹਾਡੇ ਨਾਲ ਟੈਕਨੋਲਜੀ ਬਾਰੇ ਗੱਲ ਕਰਨ ਜਾ ਰਿਹਾ ਜੋ ਕਿ ਅੱਜ ਦੇ ਯੁੱਗ ਵਿੱਚ ਕਾਫੀ ਮਸ਼ਹੂਰ ਹੈ ਟੈਕਨੋਲਜੀ ਦੇ ਵਿੱਚ ਆਈਟੀ ਵੀ ਇੱਕ ਟੈਕਨੋਲੋਜੀ ਹੈ ਇਨਫੋਰਮੇਸ਼ਨ ਟੈਕਨੋਲਜੀ ਜੋ ਕਿ ਕਾਫੀ ਮਤਲਬ ਔਖੀਆਂ ਚੀਜ਼ਾਂ ਨੂੰ ਸੌਖੇ ਤਰੀਕੇ ਨਾਲ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ ਉਹ ਇਨਫੋਰਮੇਸ਼ਨ ਟੈਕਨੋਲਜੀ ਦੇ ਥਰੂ ਕਰ ਸਕਦੇ ਹਾਂ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਕਿ ਸਾਰੇ ਕੰਮ ਹੱਥੀਂ ਹੁੰਦੇ ਸੀ ਪਰ ਹੁਣ ਸਾਰੇ ਕੰਮ ਕੰਪਿਊਟਰ ਰਾਹੀਂ ਹੋਣ ਲੱਗ ਗਏ ਹਨ ਇਸ ਦੇ ਵਿੱਚ ਕੀ ਹੈ ਕਿ ਜੋ ਕੰਮ ਹੱਥੀਂ ਕਰਨ 'ਤੇ ਤਿੰਨ ਜਾਂ ਚਾਰ ਘੰਟੇ ਲੱਗਦੇ ਸੀ ਕਈ ਦਿਨ ਵੀ ਲੰਘ ਜਾਂਦੇ ਸੀ ਉਹੀ ਕੰਪਿਊਟਰ ਦੇ ਵਿੱਚ ਅੱਜ ਕੰਮ ਸਿਰਫ ਇੱਕ ਜਾਂ ਦੋ ਘੰਟਿਆਂ ਦੇ ਵਿੱਚ ਹੋ ਜਾਂਦਾ ਹੈ ਕਈ ਦਿਨਾਂ ਦਾ ਕੰਮ ਅਸੀਂ ਕੁਝ ਘੰਟਿਆਂ ਦੇ ਵਿੱਚ ਕਰ ਸਕਦੇ ਹਾਂ ਟੈਕਨੋਲਜੀ ਇੰਨੀ ਕੁ ਜ਼ਿਆਦਾ ਫੈਲ ਚੁੱਕੀ ਹੈ ਕਿ ਅੱਜ ਅੱਜ ਦੇ ਮਨੁੱਖ ਨੂੰ ਅੱਜ ਦੇ ਜ਼ਮਾਨੇ ਵਿੱਚ ਕੁਝ ਵੀ ਕਰਨਾ ਕੁਝ ਵੀ ਔਖਾ ਨਹੀਂ ਹੈ ਇਹਦੇ ਲਈ ਮੈਂ ਤੁਹਾਡੇ ਨਾਲ ਇੱਕ ਏਆਈ ਟੈਕਨੋਲਜੀ ਬਾਰੇ ਗੱਲ ਕਰਨਾ ਚਾਹੁੰਦਾ ਹਾਂ ਜੋ ਕਿ ਆਰਟੀਫਿਸ਼ਅਲ ਇੰਟੈਲੀਜੈਂਸ ਟੈਕਨੋਲੋਜੀ ਹੈ ਇਸ ਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਦਾ ਮਤਲਬ ਹੀ ਇਹ ਹੈ ਕਿ ਕੰਮ ਨੂੰ ਕਿਵੇਂ ਸੁਖਾਲਾ ਬਣਾਇਆ ਜਾ ਸਕੇ ਅਤੇ ਬੰਦੇ ਦੀ ਜ਼ਰੂਰਤ ਨੂੰ ਕਿਵੇਂ ਘੱਟ ਕੀਤਾ ਜਾ ਸਕੇ ਉਹਦੇ ਵਿੱਚ ਇਸ ਦੇ ਵਿੱਚ ਕੀ ਹੈ ਕਿ ਜਿਵੇਂ ਆਰਟੀਫਿਸ਼ਅਲ ਇੰਟੈਲੀਜੈਂਸ ਦੀ ਮਦਦ ਨਾਲ ਆਪਾਂ ਰੋਬਟ ਤਿਆਰ ਕਰਦੇ ਹਾਂ ਰੋਬਟ ਦੀ ਮਦਦ ਨਾਲ ਆਪਾਂ ਬਹੁਤ ਕੰਮ ਲੈ ਸਕਦੇ ਹਾਂ ਪਹਿਲਾਂ ਵਾਲੇ ਅੱਜ ਦੇ ਸਮਿਆਂ ਵਿੱਚ ਲੋਕ ਕੰਮਾਂ ਵਿੱਚ ਰੁੱਝੇ ਹੋਏ ਹਨ ਘਰ ਪਰਿਵਾਰ ਦਾ ਖਿਆਲ ਰੱਖਣ ਵਿੱਚ ਇੰਨਾਂ ਬਿਜੀ ਮਤਲਬ ਧਿਆਨ ਨਹੀਂ ਦਿੱਤਾ ਜਾਂਦਾ ਬਜ਼ੁਰਗ ਮਾਪੇ ਹਨ ਜਿਸ ਕਰਕੇ ਅੱਜ ਦੀ ਟੈਕਨੋਲਜੀ ਅੱਜ ਦੇ ਬੰਦਿਆਂ ਲਈ ਕਾਫੀ ਜ਼ਰੂਰੀ ਹੈ ਜਿਸ ਦੇ ਵਿੱਚ ਏਆਈ ਰੋਬਟ ਹੈ ਜੋ ਉਸ ਦੀ ਵਰਤੋਂ ਘਰ ਵਿੱਚ ਆਪਣੇ ਬਜ਼ੁਰਗ ਮਾਂ ਪਿਓ ਦੀ ਸੇਵਾ ਕਰਨ ਲਈ ਰੱਖੀ ਜਾਂਦੀ ਹੈ ਏਆਈ ਰੋਬਟ ਨੂੰ ਜਿਵੇਂ ਵੀ ਆਪਾਂ ਕੋਈ ਕਮਾਂਡ ਦਿੰਦੇ ਹਾਂ ਜਿਵੇਂ ਵੀ ਕੋਈ ਨਿਰਦੇਸ਼ ਦਿੰਦੇ ਹਾਂ ਉਹ ਉਸੇ ਤਰ੍ਹਾਂ ਹੀ ਕੰਮ ਕਰੇਗਾ ਇਹ ਟੈਕਨੋਲਜੀ ਇੰਨੀ ਕੁ ਜ਼ਿਆਦਾ ਵਧੀਆ ਹੈ ਇਸ ਦੀ ਮਦਦ ਨਾਲ ਅਸੀਂ ਆਪਣੇ ਕਾਫੀ ਕੰਮ ਕਰ ਸਕਦੇ ਹਾਂ ਅਤੇ ਇਸ ਦੇ ਵਿੱਚ ਫੰਕਸ਼ਨ ਵੀ ਸੈਟ ਕੀਤੇ ਜਾਂਦੇ ਹਨ ਜਿਵੇਂ ਕਿ ਰੋਬੋਟ ਦੇ ਵਿੱਚ ਕਮਾਂਡ ਕੀਤੀ ਜਾਂਦੀ ਹੈ ਕਿ ਤੂੰ ਇਸ ਸਮੇਂ 'ਤੇ ਇਹੀ ਕੰਮ ਕਰਨਾ ਹੈ ਉਸ ਤੋਂ ਇਲਾਵਾ ਉਸ ਤੋਂ ਇਲਾਵਾ ਏਆਈ ਟੈਕਨੋਲਜੀ ਦੇ ਨਾਲ ਅਸੀਂ ਕੋਈ ਵੀ ਆਪਣਾ ਕੋਂਟੈਂਟ ਰਾਈਟਿੰਗ ਕਰ ਸਕਦੇ ਹਾਂ ਵੀਡੀਓ ਅਡੀਟਿੰਗ ਕੋਈ ਵੀ ਅਸੀਂ ਕਿਸੇ ਵੀ ਜਗ੍ਹਾ ਦੀ ਲੋਕੇਸ਼ਨ ਬਾਰੇ ਵਿਸਥਾਰ ਦੇ ਵਿੱਚ ਜਾਣ ਸਕਦੇ ਹਾਂ ਜਿਸ ਦੇ ਲਈ ਸਾਨੂੰ ਕੋਈ ਜ਼ਿਆਦਾ ਅੱਖਰਾਂ ਦੀ ਜ਼ਰੂਰਤ ਨਹੀਂ ਹੈ ਸਿਰਫ ਕੁਝ ਕ ਅੱਖਰ ਪਾ ਕੇ ਅਸੀਂ ਕਿਸੇ ਵੀ ਚੀਜ਼ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਏਆਈ ਦੇ ਰਾਹੀਂ ਅਸੀਂ ਏ ਪ੍ਰੰਤੂ ਏਆਈ ਦੇ ਕਾਫੀ ਨੁਕਸਾਨ ਵੀ ਹਨ ਜਿਸ ਇਸਦੇ ਨੁਕਸਾਨ ਇਹ ਹਨ ਕਿ ਜਿਸ ਤਰ੍ਹਾਂ ਮਨੁੱਖੀ ਵੀਡੀਓ ਅਡੀਟਿੰਗ ਵਗੈਰਾ ਲੋਕ ਕੰਮ ਸਿੱਖਦੇ ਹਨ ਫੋਟੋਗਰਾਫੀ ਦਾ ਕੰਮ ਸਿੱਖਦੇ ਹਨ ਹੱਥੀਂ ਸਿੱਖਦੇ ਹਨ ਪਰੰਤੂ ਏਆਈ ਨੇ ਇਹ ਕੰਮ ਲੋਕਾਂ ਦਾ ਖੋਹ ਲਿਆ ਹੈ ਏਆਈ ਟੈਕਨੋਲਜੀ ਇਸੇ ਹਿਸਾਬ ਨਾਲ ਕੰਮ ਕਰਦੀ ਆ ਕਿ ਅਗਰ ਆਪਾਂ ਇੱਕ ਕਮਾਨਡ ਦੇਵਾਂਗੇ ਤਾਂ ਆਟੋਮੈਟਿਕ ਕਈ ਘੰਟਿਆਂ ਦਾ ਕੰਮ ਮਿੰਟਾਂ ਵਿੱਚ ਕਰ ਦੇਵੇਗਾ ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਏਆਈ ਟੈਕਨੋਲੋਜੀ ਨਾਲ ਜੁੜੋ ਬਟ ਆਪਣਾ ਕੁਝ ਕੰਮ ਹੱਥੀਂ ਵੀ ਸਿੱਖੋ ਕਿਉਂਕਿ ਕੱਲ੍ਹ ਨੂੰ ਅਗਰ ਤਕਨੀਕੀ ਖਰਾਬੀ ਆਉਂਦੀ ਹੈ ਤਾਂ ਇਸਦੇ ਨੁਕਸਾਨ ਵੀ ਬਹੁਤ ਹਨ ਆਪਾਂ ਨੂੰ ਸ ਹਰ ਟਾਈਮ ਇਸ 'ਤੇ ਡਿਪੈਂਡ ਨਹੀਂ ਰਹਿਣਾ ਚਾਹੀਦਾ ਪ੍ਰੰਤੂ ਇਸਦਾ ਸਹੀ ਤਰੀਕੇ ਨਾਲ ਇਸਤੇਮਾਲ ਵੀ ਕਰਨਾ ਚਾਹੀਦਾ ਹੈ